ਮੈਂ ਅਕਸਰ ਰੇਲ ਗੱਡੀ ਦਾ ਸਫਰ ਕਰਨਾ ਪਸੰਦ ਕਰਦੇ ਹਾਂ ਕਈ ਵਾਰੀ ਮੈਂ ਰੇਲ ਗੱਡੀ ਦੇ ਵਿੱਚ ਜਾਂਦੀ ਹਾਂ ਕਿਉਂਕਿ ਉੱਥੋਂ ਦੀਆਂ ਸੀਟਾਂ ਬਹੁਤ ਮੁਲਾਇਮ ਹੁੰਦੀਆਂ ਹਨ ਅਤੇ ਉੱਥੇ ਆਵਾਜਾਈ ਵੀ ਲੱਗੀ ਰਹਿੰਦੀ ਹੈ ਸ਼ੋਰ ਸ਼ਰਾਬਾ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਸ਼ੋਰ ਸ਼ਰਾਬਾ ਵੀ ਹੁੰਦਾ ਰਹਿੰਦਾ ਹੈ ਅਤੇ ਉੱਥੋਂ ਦੇ ਪਹੀਏ ਜਿਹੜੇ ਲੋਹੇ ਦੇ ਬਣੇ ਹੁੰਦੇ ਹਨ ਰੇਲਵੇ ਇੰਜਣ ਜੋ ਹੈ ਉਹ ਟਰੈਕ 'ਤੇ ਚਲਦੀ ਹੈ ਰੇਲ ਗੱਡੀ ਇੰਜਣ ਟਰੈਕ 'ਤੇ ਚਲਦੀ ਹੈ ਇਹ ਅਸੀਂ ਮੈਂ ਦਿੱਲੀ ਦੀ ਸੈਰ ਕਰਦੀ ਹਾਂ ਅਕਸਰ ਮੈਂ ਜਦੋਂ ਵੀ ਦਿੱਲੀ ਜਾਂਦੀ ਹਾਂ ਅਤੇ ਮੈਂ ਹਮੇਸ਼ਾ ਰੇਲ ਗੱਡੀ ਰਾਹੀਂ ਹੀ ਜਾਂਦੀ ਹਾਂ ਕਿਉਂਕਿ ਮੈਨੂੰ ਰੇਲ ਗੱਡੀ ਬਹੁਤ ਵਧੀਆ ਲੱਗਦੀ